ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਤੁਹਾਨੂੰ ਇੱਕ ਖ਼ਬਰ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਕਿ ਮੈਨੂੰ ਬਹੁਤ ਹੀ ਦਿਲਚਸਪ ਲੱਗੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਲ ਹੀ ਵਿੱਚ ਸਰਕਾਰ ਨੇ ਇੱਕ ਯੋਜਨਾ ਲਾਗੂ ਕੀਤੀ ਹੈ ਕਿ ਜਿਹੜੇ ਬੱਚੇ ਯੂ ਪੀ ਐੱਸ ਸੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਰਕਾਰੀ ਸੰਸਥਾ ਵਿੱਚ ਜਾ ਕੇ ਫ੍ਰੀ ਤਿਆਰੀ ਕਰ ਸਕਦੇ ਹਨ ਮੈਨੂੰ ਇਹ ਯੋਜਨਾ ਬਾਰੇ ਸੁਣ ਕੇ ਬਹੁਤ ਹੀ ਵਧੀਆ ਲੱਗਾ ਅਤੇ ਮੈਨੂੰ ਇਹ ਯੋਜਨਾ ਬਹੁਤ ਹੀ ਦਿਲਚਸਪ ਲੱਗੀ ਯੂ ਪੀ ਐੱਸ ਸੀ ਪੇਪਰ ਬਹੁਤ ਹੀ ਉੱਚੇ ਦਰਜੇ ਦਾ ਪੇਪਰ ਹੈ ਅਤੇ ਇਸ ਦੀ ਤਿਆਰੀ ਲਈ ਬਹੁਤ ਹੀ ਮਿਹਨਤ ਅਤੇ ਪੈਸਾ ਲੱਗਦਾ ਹੈ ਜੋ ਕਿ ਹਰ ਇੱਕ ਆਮ ਵਿਦਿਆਰਥੀ ਅਫੋਡ ਨਹੀਂ ਕਰ ਸਕਦਾ ਸਰਕਾਰ ਦੇ ਇਸ ਕਦਮ ਵੱਲੋਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਉਹਨਾਂ ਦੇ ਇਹ ਕਦਮ ਨਾਲ ਹਰ ਇੱਕ ਬੱਚਾ ਜੋ ਕਿ ਆਮ ਪਰਿਵਾਰ ਤੋਂ ਸੰਬੰਧ ਕਰਦਾ ਹੈ ਸੰਬੰਧ ਰੱਖਦਾ ਹੈ ਉਹ ਆਪਣੇ ਟੇਲੈਂਟ ਨੂੰ ਦੇਸ਼ ਅੱਗੇ ਦਿਖਾ ਪਾਵੇਗਾ ਅਤੇ ਇਸ ਨਾਲ ਦੇਸ਼ ਦੀ ਤਰੱਕੀ ਵੀ ਹੋਵੇਗੀ ਬੱਚੇ ਪੜ੍ਹ ਲਿਖ ਕੇ ਵਧੀਆ ਨੌਕਰੀ 'ਤੇ ਲੱਗਣਗੇ ਅਤੇ ਹੋਰ ਬੱਚੇ ਉਹਨਾਂ ਤੋਂ ਜਾਗਰੂਕ ਹੋਣਗੇ ਸਰਕਾਰ ਬੱਚਿਆਂ ਨੂੰ ਉਚਾਈਆਂ 'ਤੇ ਪਹੁੰਚਾਉਣ ਲਈ ਬਹੁਤ ਹੀ ਵਧੀਆ ਕਦਮ ਚੁੱਕ ਰਹੀ ਹੈ ਮੈਂ ਭਾਰਤ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਧੰਨਵਾਦ